ਮੈਂ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਦਰ ਆਪਣੇ ਮਾਪਿਆਂ ਦੀ ਕਰਦੀ ਹਾਂ ਕਿਉਂਕਿ ਉਹਨਾਂ ਦੇ ਹੀ ਬਲਬੂਤੇ 'ਤੇ ਮੈਂ ਅੱਜ ਜੋ ਹਾਂ ਸੋ ਹਾਂ ਉਹਨਾਂ ਨੇ ਜਿੰਨੀ ਮਿਹਨਤ ਮੇਰੀ ਪੜ੍ਹਾਈ 'ਤੇ ਕੀਤੀ ਸੀ ਅਤੇ ਮੈਨੂੰ ਇਸ ਮੁਕਾਮ 'ਤੇ ਲਾਇਆ ਕਿ ਮੈਂ ਅੱਜ ਕੁਝ ਬਣ ਸਕਾਂ ਉਹ ਸਭ ਮੇਰੇ ਮਾਪਿਆਂ ਦੀ ਹੀ ਬਦੌਲਤ ਹੈ ਮੈਂ ਆਪਣੇ ਮਾਪਿਆਂ ਨੂੰ ਹੀ ਆਪਣਾ ਸਭ ਮੰਨਦੀ ਹਾਂ ਅਤੇ ਉਹਨਾਂ ਲਈ ਹੀ ਸਭ ਕੁਛ ਕਰਦੀ ਹਾਂ ਮੈਂ ਉਹਨਾਂ ਨੂੰ ਦੁਨੀਆ ਦੀ ਹਰ ਇੱਕ ਖੁਸ਼ੀ ਦੇਣਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਮੇਰੀ ਪੜ੍ਹਾਈ ਅਤੇ ਮੇਰੇ ਫਿਊਚਰ ਅਤੇ ਮੇਰੀ ਹੀ ਜ਼ਿੰਦਗੀ 'ਤੇ ਸਾਰੇ ਦੇ ਸਾਰੇ ਆਪਣੇ ਸੁਪਨੇ ਕੁਰਬਾਨ ਕੀਤੇ ਹਨ ਮੇਰੇ ਭੈਣ ਭਰਾਵਾਂ ਦੀ ਵੀ ਪੜ੍ਹਾਈ ਅਤੇ ਮੇਰੇ 'ਤੇ ਆਪਣੇ ਬੱਚਿਆਂ ਦੇ ਲਈ ਹੀ ਉਹਨਾਂ ਨੇ ਆਪਣੇ ਸੁਪਨੇ ਅਲੱਗ ਰੱਖ ਕੇ ਸਾਨੂੰ ਪੜ੍ਹਾਇਆ ਲਿਖਾਇਆ ਸਾਡੀ ਹਰ ਇੱਕ ਖਾਹਿਸ਼ ਪੂਰੀ ਕੀਤੀ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਸਭ ਤੋਂ ਵੱਧ ਕਦਰ ਆਪਣੇ ਮਾਪਿਆਂ ਦੀ ਹੀ ਕਰਾਂਗੀ ਚਾਹੇ ਕੁਝ ਵੀ ਹੋ ਜਾਏ ਸਾਨੂੰ ਆਪਣੇ ਮਾਪਿਆਂ ਦਾ ਹਰ ਗੱਲ ਨੂੰ ਮੱਥੇ 'ਤੇ ਮੱਥੇ ਸਿਰ ਰੱਖਣਾ ਚਾਹੀਦਾ ਹੈ ਹਰ ਗੱਲ ਮੰਨਣੀ ਚਾਹੀਦੀ ਉਹਨਾਂ ਦੀ ਚਾਹੇ ਉਹ ਕੋਈ ਵੀ ਫੈਸਲਾ ਕਿਉਂ ਨਾ ਕਰਨ ਉਹਨਾਂ ਦਾ ਫੈਸਲਾ ਸਾਡੇ ਲਈ ਹਮੇਸ਼ਾ ਸਹੀ ਹੀ ਸਾਬਿਤ ਹੁੰਦਾ ਹੈ ਹਾਂ ਕਈ ਪ ਕਈ ਪਹਿਰਾਵੇ ਇੱਦਾਂ ਦੇ ਵੀ ਆਉਂਦੇ ਹਨ ਜਿੱਥੇ ਸਾਨੂੰ ਲੱਗਦਾ ਹੈ ਕਿ ਸਾਡੇ ਮਾਪੇ ਗਲਤ ਹਨ ਪਰ ਉਹ ਹਮੇਸ਼ਾ ਸਾਡੀ ਖੁਸ਼ੀ ਹੀ ਚਾਹੁੰਦੇ ਹਨ ਅਤੇ ਸਾਡੀ ਖੁਸ਼ੀ ਲਈ ਹੀ ਕਰਦੇ ਹਨ ਤਾਂ ਕਈ ਵਾਰੀ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਸਾਨੂੰ ਵੀ ਉਹਨਾਂ ਦੀ ਖੁਸ਼ੀ ਲਈ ਆਪਣੇ ਕੁਛ ਸੁਪਨੇ ਆਪਣੇ ਕੁਛ ਅਰਮਾਨ ਛੱਡਣੇ ਪੈਣ ਤਾਂ ਸਾਨੂੰ ਛੱਡ ਦੇਣੇ ਚਾਹੀਦੇ ਹਨ ਇਸ ਤੋਂ ਵੱਧ ਹੋਰ ਉਹਨਾਂ ਦੀ ਆ ਖੁਸ਼ੀ ਲਈ ਆਪਾਂ ਕੀ ਹੀ ਕਰ ਸਕਦੇ ਹਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਬੱਚੇ ਨੂੰ ਆਪਣੇ ਮਾਪਿਆਂ ਦਾ ਬਾਰੇ ਮਾਪਿਆਂ ਦੇ ਬਾਰੇ ਸੋਚਣਾ ਚਾਹੀਦਾ ਹੈ ਕਿਉਂ ਕਿਵੇਂ ਸਾਨੂੰ ਇਨੇ ਮੁਸ਼ਕਿਲ ਸਮੇਂ 'ਚ ਜਿੱਥੇ ਇੰਨਾ ਇੰਨੀ ਮਹਿੰਗਾਈ ਦਾ ਸਮਾਂ ਚੱਲਣ ਦਿਆ ਵਾ ਉੱਥੇ ਪਾਲ ਰਹੇ ਨੇ ਪੋਸ ਰਹੇ ਨੇ ਪੜ੍ਹਾ ਰਹੇ ਨੇ ਤਾਂ ਸਾਨੂੰ ਵੀ ਉਹਨਾਂ ਬਾਰੇ ਥੋੜ੍ਹਾ ਬਹੁਤਾ ਕੁਛ ਸੋਚਣਾ ਚਾਹੀਦਾ ਹੈ ਧੰਨਵਾਦ